ਪਟਿਆਲਾ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਯੋਗਾ ਕਲਾਸਿਸ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਯੋਗਾ ਬਾਰੇ ਦੱਸਿਆ ਜਾਂਦਾ ਹੈ ਆਯੁਰਵੈਦਿਕ ਬਾਰੇ ਵੀ ਦੱਸਿਆ ਜਾਂਦਾ ਹੈ ਆਯੁਰਵੈਦ ਵਿੱਚ ਡੋਕਟਰਸ ਨੇਗੇ ਜਿਵੇਂ ਉਹ ਲੋਕਾਂ ਨੂੰ ਦੱਸਦੇ ਨੇ ਵੀ ਆਯੁਰਵੈਦਿਕ ਬਾਰੇ ਵੀ ਕਿਵੇਂ ਇਲਾਜ ਕੀਤਾ ਜਾ ਸਕਦਾ ਹੈ ਯੋਗਾ ਵਿੱਚ ਜਿਵੇਂ ਸਾਡੇ ਰਿਸ਼ਤੇਦਾਰ ਆਉਂਦੇ ਹਨ ਅਤੇ ਉਹ ਯੋਗਾ ਕਰਕੇ ਜਾਂਦੇ ਹਨ ਪਟਿਆਲੇ ਵਿੱਚ ਅਤੇ ਆਪਣਾ ਨਾਲ਼ ਨਾਲ਼ ਆਯੁਰਵੈਦਿਕ ਇਲਾਜ ਵੀ ਕਰਵਾ ਕੇ ਜਾਂਦੇ ਹਨ ਇੱਥੇ ਯੋਗਾ ਡੇ ਵਾਲੇ ਦਿਨ ਬਾਬਾ ਰਾਮਦੇਵ ਵੀ ਯੋਗਾ ਨਾਲ਼ ਲੋਕਾਂ ਨਾਲ਼ ਬੈਠ ਕੇ ਯੋਗਾ ਕਰਕੇ ਜਾਂਦੇ ਹਨ ਅਤੇ ਉਹਨਾਂ ਨੂੰ ਦੱਸ ਕੇ ਜਾਂਦੇ ਹਨ ਯੋਗਾ ਕਰਨ ਦੇ ਕੀ ਕੀ ਫਾਇਦੇ ਹਨ ਯੋਗਾ ਸਾਡੇ ਸਰੀਰ ਲਈ ਬ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੈ ਅਤੇ ਸਾਡਾ ਆਯੁਰਵੈਦਿਕ ਦਾ ਇਲਾਜ ਬਾਰੇ ਵੀ ਉਹ ਦੱਸ ਕੇ ਜਾਂਦੇ ਹਨ